ਹਾਂ ਅਸੀਂ ਸਰਕਾਰ ਦੀਆਂ ਬੇ ਸਕੀਮਾਂ ਤੋਂ ਜਾਣੂ ਹਾਂ ਸਿਹਤ ਸੰਭਾਲ ਲਈ ਸਰਕਾਰ ਨੇ ਬਹੁਤ ਜਿਆਦਾ ਕਦਮ ਚੁੱਕੇ ਹਨ ਜਿਵੇਂ ਕਿ ਪੰਜ ਲੱਖ ਦਾ ਬੀਮਾ ਕਾਰਡ ਬਣਾਇਆ ਹੈ ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਬੈਨੀਫਿਟ ਹੋ ਰਿਹਾ ਹੈ ਪਰ ਇਹ ਕਾਰਡ ਕਿਤੇ ਚੱਲਦੇ ਹਨ ਅਤੇ ਕਿਤੇ ਨਹੀਂ ਚੱਲਦੇ ਕਈ ਹੋਸਪਿਟਲਾਂ ਵਿੱਚ ਇਸ ਨਾਲ ਇਲਾਜ ਹੋ ਜਾਂਦਾ ਅਤੇ ਇਸ ਇਸ ਕਦੇ ਇਸ ਨਾਲ ਨਹੀਂ ਹੁੰਦਾ ਜੇ ਨਹੀਂ ਹੁੰਦਾ ਤਾਂ ਉਸ ਲੋਕਾਂ ਨੂੰ ਬਹੁਤ ਔਖਾ ਹੋ ਜਾਂਦਾ ਅਤੇ ਵੱਡੇ ਤੋਂ ਵੱਡਾ ਮਤਲਬ ਕੋਈ ਓਪਰੇਸ਼ਨ ਕਰਵਾਉਣਾ ਕੁਛ ਹੋਰ ਕਰਵਾਉਣਾ ਤਾਂ ਉੱਥੇ ਨਹੀਂ ਚੱਲਦਾ ਤਾਂ ਉਹਨਾਂ ਲੋਕਾਂ ਨੂੰ ਪੈਸਾ ਲਾਉਣਾ ਬਹੁਤ ਔਖਾ ਹੋ ਜਾਂਦਾ ਇਹ ਸਾਰੇ ਹੋਸਪਿਟਲਾਂ ਵਿੱਚ ਹੀ ਚੱਲਣੇ ਚਾਹੀਦੇ ਹਨ ਇਹ ਨਾ ਹੋਵੇ ਕਿ ਕਿਸੇ ਕਿਸੇ ਹੋਸਪਿਟਲ 'ਚ ਚੱਲਦੇ ਹਨ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇਸਦੀ ਸੇਵਾ ਲੈਣੀ ਇਹ ਸਕੀਮਾਂ ਲਾਭ ਲੈਣਾ ਮਤਲਬ ਕਿ ਜਿਹੜੇ ਮਤਲਬ ਛੋਟੇ ਲੋਕ ਨੇ ਜਿਹੜੇ ਇਲਾਜ ਨਹੀਂ ਕਰ ਸਕਦੇ ਲਾਭਪਾਤਰੀ ਕਾਰਡਾਂ ਵਿੱਚ ਆਉਂਦੇ ਹਨ ਉਹਨਾਂ ਨੂੰ ਇਹ ਉਹ ਲੋਕ ਇਹਨਾਂ ਦਾ ਲਾਭ ਲੈਂਦੇ ਹਨ ਅਤੇ ਇਹ ਇਹ ਇਹਨਾਂ ਦੀ ਆਈਡੀ ਲੈਣ ਵਾਸਤੇ ਲੈਂਦੇ ਹਨ ਅਤੇ ਬੀਮਾ ਅਤੇ ਬਣ ਜਾਂਦਾ ਹੈ ਅੱਜ ਕੱਲ੍ਹ ਤਾਂ ਹੁਣ ਆਉਣ ਵਾਲੀ ਸਰਕਾਰ ਨੇ ਤਾਂ ਇਹ ਬੈਨੀਫਿਟ ਦੇ ਦਿੱਤਾ ਹੈ ਕਿ ਜਦੋਂ ਕਿਸੇ ਵੀ ਹੋਸਪਿਟਲ 'ਚ ਜਾਣਾ ਤਾਂ ਸਿਹਤ ਹੈਲਥ ਆਈਡੀ ਬਣ ਚੁੱਕੀ ਹੈ ਤਾਂ ਉਹ ਆਪਣੇ ਫੋਨ ਦੇ ਵਿੱਚ ਇਹ ਰਿਕਾਰਡ ਓਹ ਆਈਡੀ ਨੰਬਰ ਹੀ ਦੇਣਾ ਹੋਊਗਾ ਤਾਂ ਹੀ ਉਹਦੇ ਵਿੱਚ ਆਈਡੀ ਨੰਬਰ ਦੇਖ ਕੇ ਤਾਂ ਜਦੋਂ ਆਪਾਂ ਕਿਸੇ ਹੋਸਪਿਟਲ ਵਿੱਚ ਦਵਾਈ ਲੈਣ ਜਾਵਾਂਗੇ ਤਾਂ ਉਹਨਾਂ ਨੂੰ ਉਹ ਸਾਰਾ ਰਿਕਾਰਡ ਉਸ ਆਈਡੀ ਵਿੱਚ ਹੋਊਗਾ ਤਾਂ ਆਪਾਂ ਨੂੰ ਦੱਸਣਾ ਨਹੀਂ ਪਊਗਾ ਅਸੀਂ ਕਾਹਦੀ ਦਵਾਈ ਖਾਂਨੇ ਆਂ ਕੀ ਖਾਨੇ ਆ ਕਿਹੜੀ ਦਵਾਈ ਤੋਂ ਸਾਨੂੰ ਅਲਰਜੀ ਆ ਤਾਂ ਉਸ ਵਿੱਚ ਹੀ ਸਾਰਾ ਰਿਕੋਰਡ ਹੋਊਗਾ ਤਾਂ ਉਹਨਾਂ ਨੇ ਉਹ ਆਈਡੀ ਵਿੱਚ ਰਿਕੋਰਡ ਕੱਢ ਕੇ ਦੇਖ ਲੈਣਾ ਤਾਂ ਇਹਦੇ ਵਿੱਚ ਕਿ ਵੀ ਕਿਹੜੀ ਦਵਾਈ ਇਹਨਾਂ ਨੂੰ ਰਿਐਕਸ਼ਨ ਕਰਦੀ ਹੈ ਐਲਰਜੀ ਕਰਦੀ ਹੈ ਇੱਦਾਂ ਜਾਂ ਕਿਹੜੀ ਦਵਾਈ ਇਹਨਾਂ ਦੀ ਚੱਲ ਰਹੀ ਹੈ ਕਿਹੜਾ ਇਲਾਜ ਚੱਲ ਰਿਹਾ ਇਸ ਕਰਕੇ ਸਾਨੂੰ ਇਹਨਾਂ ਸਿਹਤ ਸੰਭਾਲ ਦੀ ਬਹੁਤ ਹੀ ਵਧੀਆ ਗੱਲਾਂ ਵੀ ਲੱਗਦੀਆਂ ਹਨ ਤਾਂ ਜਿਹੜੇ ਵੀ ਮਗੜ ਹਨ ਉਹ ਸਾਰੇ ਹੀ ਤਰ੍ਹਾਂ ਚੱਲਣੇ ਚਾਹੀਦੇ ਹਨ ਸਾਰੇ ਚੱਲਣੇ ਚਾਹੀਦੇ ਹਨ ਅਤੇ ਜਿਹੜੇ ਲੋਕ ਇਹਨਾਂ ਤੋਂ ਵਾਂਝੇ ਰਹਿ ਜਾਂਦੇ ਹਨ ਉਹਨਾਂ ਨੂੰ ਵੀ ਇਹ ਸਕੀਮਾਂ ਦਾ ਪਤਾ ਲੱਗਣਾ ਚਾਹੀਦਾ ਹੈ ਕੋਈ ਹਰ ਇੱਕ ਬੰਦੇ ਆਮ ਬੰਦੇ ਕੋਲ ਵੀ ਹਰ ਇੱਕ ਸਕੀਮ ਪਹੁੰਚਣੀ ਚਾਹੀਦੀ ਹੈ ਅਤੇ ਅਰਜ਼ੀ ਵਗੈਰਾ ਦੇਣੀਆਂ ਦਾ ਲਾਭ ਲੈਣਾ ਤਾਂ ਉਸ ਨੇ ਸੁਵਿਧਾ ਕੇਂਦਰ ਵਿੱਚ ਜਾ ਕੇ ਅਰਜ਼ੀ ਵਗੈਰਾ ਲਿਖ ਕੇ ਫੋਮ ਭਰ ਕੇ ਅਰਜ਼ੀ ਵਗੈਰਾ ਦਿੱਤੀ ਜਾ ਸਕਦੀ ਹੈ